ਹੈਲੋ ਆ ਮੈਮ ਸਤਿ ਸ਼੍ਰੀ ਅਕਾਲ ਹੋਰ ਘਰ ਠੀਕ ਆ ਮੈਮ ਮੈਨੂੰ ਤੁਹਾਡੇ ਤੋਂ ਐਕਟੀਵਿਟੀਜ਼ ਬਾਰੇ ਪੁੱਛਣਾ ਸੀ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਸਕੂਲ 'ਚ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਟਾਈਮਿੰਗ ਕਿਵੇਂ ਇਹਨਾਂ ਦੀ ਹਾਂਜੀ ਠੀਕ ਹੈ ਜੀ ਠੀਕ ਏ ਜੀ ਅਤੇ ਸਕੂਲ 'ਚ ਬੱਸ ਸੁਵਿਧਾ ਹੈਗੀ ਹੈ ਠੀਕ ਏ ਹਾਂਜੀ ਠੀਕ ਏ ਜੀ ਠੀਕ ਏ ਠੀਕ ਏ ਜੀ ਹਾਂਜੀ ਠੀਕ ਏ ਜੀ

ਠੀਕ ਏ ਓਕੇ ਮੈਮ ਓਕੇ